ਹੈਲੋ ਬਸ ਵਧੀਆ ਹੋਰ ਹੋਰ ਠੀਕ ਠਾਕ ਹੈਂ ਦਿਲ ਨਾ ਆ ਜੋ ਕਦੋਂ ਆਵਾਂ ਚਲੋ ਠੀਕ ਆ ਪਤਾ ਨਹੀਂ ਹਜੇ ਕਾਹਦੀ ਗੱਲ ਦਾ ਇਸ਼ੂ ਚੱਲਦਾ ਪਿਆ ਆ ਕੇ ਪੁੱਛ ਲੀ ਇਹ ਇਸ਼ੂ ਤਾਂ ਆਪੇ ਚੱਲਣੇ ਜਦ ਜੁਬਾਨਾਂ ਤਾਂ ਬੰਦ ਨਹੀਂ ਰੱਖਣੀਆਂ ਜੇ ਸਹਿਣ ਸ਼ਕਤੀ ਨਹੀਂ ਹੈਗੀ ਤਾਂ ਫਿਰ ਇਸ਼ੂ ਤਾਂ ਆਪੇ ਹੋਣਗੇ

ਹਮ ਹਮ ਅੱਛਾ ਆਪ ਸਪੋਰਟਡ ਹੈਗੇ ਹੈਗੀ ਨਹੀਂ ਨਾ ਅੱਜ ਕੱਲ੍ਹ ਹੈ ਤਾਂ ਹੈ ਨਹੀਂ ਨਾ ਅੱਜ ਕੱਲ੍ਹ ਕੁੜੀਆਂ 'ਚ ਸਹਿਣ ਸ਼ਕਤੀ ਨਹੀਂ ਹੈਗੀ ਓਕੇ ਜੀ